ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਜੀ ਭਾਅ ਜੀ ਰੀਤ ਟਰੈਵਲ ਏਜੰਸੀ ਤੋਂ ਬੋਲਦੇ ਹੈ ਜੀ ਮੈਂ ਭਾਅ ਜੀ ਤੁਹਾਡੀ ਆ ਕੈਬ ਬੁੱਕ ਕੀਤੀ ਸੀਗੀ ਆਪਾਂ ਸ਼ਿਮਲੇ ਘੁੰਮਣ ਵਾਸਤੇ ਉੱਧਰ ਮੈਂ ਭਾਅ ਜੀ ਤੁਹਾਡੇ ਤੋਂ ਇਹ ਪੁੱਛਣਾ ਸੀਗਾ ਵੀ ਤੁਹਾਡੀ ਮੈਂ ਜਿਹੜੀ ਪੇਮੈਂਟ ਹੈਗੀ ਹੈ ਉਹ ਕੈਸ਼ ਕਰ ਸਕਦਾ ਹੈ ਜਿੱਦਾਂ ਭਾਅ ਜੀ ਤੁਸੀਂ ਮੈਨੂੰ ਪਹਿਲਾਂ ਕਿਹਾ ਤਾ ਵੀ ਸਾਨੂੰ ਪੇਮੈਂਟ ਤੁਸੀਂ ਔਨਲਾਈਨ ਕਰ ਦਿਓ ਵੀ ਔਨਲਾਈਨ ਤਾਂ ਭਾਅ ਜੀ ਹੁਣ ਘੁੰਮਣ ਕਰਕੇ ਮੇਰੇ ਸਾਰੇ ਵੀ ਪੈਸੇ ਪੂਸੇ ਖਰਚ ਹੋ ਗਏ ਹੈਗੇ ਹੈ ਹੁਣ ਮੈਂ ਇਹੀ ਕਨਫਰਮ ਕਰਨਾ ਸੀਗਾ ਵੀ ਮੈਂ ਹੁਣ ਮੈਂ ਤੁਹਾਨੂੰ ਕੈਸ਼ ਪੇਮੈਂਟ ਕਰ ਦਿੰਦਾ ਹੈਗਾ ਹੈ ਮੈਂ ਦੱਸ ਦਿਓ ਭਾਅ ਜੀ ਜਦ ਵੀ ਜਿੱਥਾ ਵੀ ਪਜਾਣੀ ਹੋਈ ਤੁਸੀਂ ਜਿੱਦਾਂ ਵੀ ਮਤਲਬ ਕਰਨਾ ਹੋਇਆ ਮੈਂ ਤੁਹਾਨੂੰ ਕਢਵਾ ਕੇ ਦੇ ਦੂੰਗਾ ਭਾਅ ਜੀ ਠੀਕ ਆ ਭਾਅ ਜੀ ਧੰਨਵਾਦ ਜੀ